ਰਸੋਈ ਵਿੱਚ ਵੱਖ ਵੱਖ ਬਰਤਨ ਵਰਤੇ ਜਾਂਦੇ ਹਨ ਜਿਵੇਂ ਕਿ ਪਤੀਲਾ ਇਹ ਭੋਜਨ ਪਕਾਉਣ ਲਈ ਵਰਤਿਆ ਜਾਂਦਾ ਹੈ ਜਿਵੇਂ ਕਿ ਸਬਜ਼ੀਆਂ ਦਾਲਾਂ ਅਤੇ ਚੌਲ ਫਿਰ ਕੜਾਹੀ ਇਹ ਇੱਕ ਗੋਲ ਅਤੇ ਚੌੜਾ ਭਾਂਡਾ ਹੈ ਜੋ ਸਬਜ਼ੀਆਂ ਬਣਾਉਣ ਤਲਣ ਅਤੇ ਹੋਰ ਪਕਵਾਨਾਂ ਲਈ ਵਰਤਿਆ ਜਾਂਦਾ ਹੈ ਤਵਾ ਇਹ ਰੋਟੀਆਂ ਪਰੌਂਠੇ ਸੇਕਣ ਅਤੇ ਬਣਾਉਣ ਲਈ ਵਰਤਿਆ ਜਾਂਦਾ ਹੈ ਫਿਰ ਚਾਕੂ ਇਹ ਸਬਜ਼ੀਆਂ ਫਲ ਅਤੇ ਮੀਟ ਕੱਟਣ ਲਈ ਵਰਤਿਆ ਜਾਂਦਾ ਹੈ ਵੱਖ ਵੱਖ ਕੰਮਾਂ ਲਈ ਵੱਖ ਵੱਖ ਕਿਸਮਾਂ ਦੇ ਚਾਕੂ ਹੁੰਦੇ ਹਨ ਫਿਰ ਕਟਿੰਗ ਬੋਰਡ ਇਹ ਸਬਜ਼ੀਆਂ ਅਤੇ ਹੋਰ ਚੀਜ਼ਾਂ ਕੱਟਣ ਲਈ ਇੱਕ ਸੁਰੱਖਿਆ ਸੱਤਾ ਪ੍ਰਦਾਨ ਕਰਦਾ ਹੈ ਫਿਰ ਮਾਪਣ ਵਾਲੇ ਕੱਪ ਅਤੇ ਚਮਚੇ ਵੀ ਹੁੰਦੇ ਹਨ ਇਹ ਖਾਣਾ ਬਣਾਉਣ ਵਿੱਚ ਸਮਗਰੀਆਂ ਦੀ ਸਹੀ ਮਾਤਰਾ ਨੂੰ ਮਾਪਣ ਲਈ ਵਰਤੇ ਜਾਂਦੇ ਹਨ ਕਟੋਰੇ ਇਹ ਚੀਜ਼ਾਂ ਮਿਲਾਉਣ ਮਿਕਸ ਕਰਨ ਅਤੇ ਹੋਰ ਚੀਜ਼ਾਂ ਵਾਸਤੇ ਵਰਤੇ ਜਾਂਦੇ ਹਨ ਚਮਚਾ ਇਹ ਭੋਜਨ ਪਰੋਸਣ ਅਤੇ ਹਿਲਾਉਣ ਲਈ ਵਰਤਿਆ ਜਾਂਦਾ ਹੈ ਛਾਨਣੀ ਇਹ ਪਾਣੀ ਜਾਂ ਸਾਡਾ ਤੇਲ ਹੋ ਗਿਆ ਜਾਂ ਚਾਹ ਹੋ ਗਈ ਉਹਨੂੰ ਛਾਨਣ ਵਾਸਤੇ ਵਰਤਿਆ ਜਾਂਦਾ ਹੈ ਕੱਦੂਕਸ ਬਹੁਤ ਸਾਰੀ ਸਬਜ਼ੀਆਂ ਪਨੀਰ ਅਤੇ ਹੋਰ ਚੀਜ਼ਾਂ ਨੂੰ ਕੱਦੂਕਸ ਕਰਨ ਲਈ ਕੱਦੂਕਸ ਨੂੰ ਵਰਤਿਆ ਜਾਂਦਾ ਹੈ ਫਿਰ ਇੱਕ ਕੈਨ ਓਪਨਰ ਵੀ ਹੁੰਦਾ ਹੈ ਜੋ ਡੱਬਿਆਂ ਨੂੰ ਖੋਲ੍ਹਣ ਲਈ ਵਰਤਿਆ ਜਾਂਦਾ ਹੈ ਫਿਰ ਛਿੱਲਣੀ ਇਹ ਫਲਾਂ ਅਤੇ ਸਬਜ਼ੀਆਂ ਦੇ ਛਿਲਕੇ ਨੂੰ ਉਤਾਰਨ ਲਈ ਵਰਤਿਆ ਜਾਂਦਾ ਹੈ